ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਾਨਵ ਸਿੰਘ ਪਠਾਨਕੋਟ ਵਿਖੇ ਰਹਿੰਦਾ ਹਾਂ ਜਿੱਦਾਂ ਕਿ ਇਹਨਾਂ ਦਾ ਪ੍ਰਸ਼ਨ ਹੈ ਪੰਜਾਬ ਵਿੱਚ ਲੋਕ ਆਪਣੀ ਰਚਨ ਮਾਤਕਤਾ ਅਤੇ ਕਲਾਤਮਕ ਪ੍ਰਤਿਭਾ ਨੂੰ ਕਿਵੇਂ ਪ੍ਰਗਟ ਕਰਦੇ ਹਨ ਇਸ ਦਾ ਉੱਤਰ ਮੈਂ ਇਸ ਪ੍ਰਕਾਰ ਦਾਵਾਂਗਾ ਜਿੱਦਾਂ ਕਿ ਸਾਡੇ ਕਾਰਪੇਂਟਰ ਹੁੰਦੇ ਹਨ ਕਾਰਪੇਂਟਰ ਜਿੱਦਾਂ ਕਿ ਕੋਈ ਲੱਕੜੀ 'ਤੇ ਤਰਕੀਸ਼ ਕਰਦੇ ਹਨ ਅਤੇ ਉਹਨੂੰ ਬਹੁਤ ਬਹੁਤ ਸੋਹਣੀਆਂ ਚੀਜ਼ਾਂ ਬਣਾਉਂਦੇ ਹਨ ਅਤੇ ਜਿੱਦਾਂ ਕਿ ਕੁਝ ਲੋਕ ਕਢਾਈ ਕਰਦੇ ਹਨ ਅਤੇ ਅਸੈਕਟਰਾ ਧੰਨਵਾਦ